ਜਦੋਂ ਮੈਂ ਕੋਈ ਵੀ ਕੰਮ ਕਰਕੇ ਵਿਹਲੀ ਹੁੰਦੀ ਹਾਂ ਜਦ ਜਾਂ ਮੇਰੇ ਕੋਲ ਕੋਈ ਸਮ ਸਮਾਂ ਵਿਹਲਾ ਹੁੰਦਾ ਹੈ ਤਾਂ ਮੈਂ ਉਹਦੇ 'ਚ ਚਿੱਤਰਕਾਰੀ ਕਰਦੀ ਹਾਂ ਕਿਉਂਕਿ ਮੈਨੂੰ ਚਿੱਤਰਕਾਰੀ ਕਰਨਾ ਬਹੁਤ ਪਸੰਦ ਹੈ ਅਤੇ ਜਦੋਂ ਮੈਂ ਚਿੱਤਰਕਾਰੀ ਕਰਦੀ ਹਾਂ ਮੈਨੂੰ ਅਲੱਗ ਹੀ ਖੁਸ਼ੀ ਮਿਲਦੀ ਹੈ ਅਤੇ ਆਨੰਦ ਆਉਂਦਾ ਜਾਂ ਫਿਰ ਮੈਂ ਕਦੇ ਕਦੇ ਡਾਂਸ ਡਾਂਸ ਵੀ ਕਰਨਾ ਮੈਨੂੰ ਬਹੁਤ ਪਸੰਦ ਹੈ ਬਚਪਨ ਤੋਂ ਹੀ ਮੈਨੂੰ ਬਹੁਤ ਸ਼ੌਕ ਹੈ ਮੈਂ ਡਾਂਸ ਕਰਕੇ ਆਨੰਦ ਲੈਂਦੀ ਹਾਂ ਅਤੇ ਆਪਣਾ ਮੈਨੂੰ ਅੰਦਰੋਂ ਸਕੂਨ ਮਿਲਦਾ ਹੈ ਜਦੋਂ ਮੈਂ ਡਾਂਸ ਕਰਦੀ ਹਾਂ ਅਤੇ ਜਾਂ ਫਿਰ ਚਿੱਤਰਕਾਰੀ ਅਲੱਗ ਅਲੱਗ ਤਰ੍ਹਾਂ ਦੀ ਆਰਟ ਐਂਡ ਕਰਾਫਟ ਕਰ ਲੈਣੀ ਹਾਂ ਹੋਮ ਘਰ ਨੂੰ ਸ ਡੈਕੋਰੇਟ ਕਰਨ ਲਈ ਵੇਸ਼ਟ ਮਟੀਰੀਅਲ ਤੋਂ ਕੋਈ ਨਾ ਕੋਈ ਨਵੀਂ ਚੀਜ਼ ਬਣਾ ਲੈਣੀ ਕੁਛ ਵਧੀਆ ਜਿਹਾ ਬਣਾ ਲੈਣਾ ਚਿੱਤਰਕਾਰੀ ਕਰ ਲੈਣੀ ਕਿਸੇ ਚੀਜ਼ ਦੀ ਡਰੋਇੰਗ ਕਰ ਲੈਣੀ ਜਾਂ ਪੇਂਟਿੰਗ ਵਗੈਰਾ ਕਰ ਲੈਣੀ ਮੈਨੂੰ ਬਹੁਤ ਸ਼ੌਕ ਹੈ ਇਹਨਾਂ ਚੀਜ਼ਾਂ ਦਾ ਅਤੇ ਜੋ ਕੁਝ ਜਦੋਂ ਕੋਈ ਕੋਈ ਇਮੈਜੀਨੇਸ਼ਨ ਕਰ ਇਮੈਜੀਨੇਸ਼ਨ ਕਰਕੇ ਕੋਈ ਚੀਜ਼ ਜਦੋਂ ਇਮੈਜੀਨ ਕਰਕੇ ਉਦੋਂ ਉਹਨੂੰ ਕੋਈ ਮੌਸਮ ਹੋ ਗਿਆ ਕੋਈ ਮੀਂਹ ਤੋਂ ਬਾਅਦ ਜਦੋਂ ਸਤਰੰਗੀ ਪੀਂਘ ਬਣਦੀ ਆ ਅਸਮਾਨ 'ਚ ਉਹਨੂੰ ਇਮੈਜਿਨ ਕਰ ਲੈਣਾ ਉਹਨੂੰ ਇਮੈਜਿਨ ਕਰਕੇ ਚਿੱਤਰਕਾਰੀ ਕਰ ਦੇਣੀ ਤਾਂ ਮੈਨੂੰ ਅੰਦਰੋਂ ਅਲੱਗ ਹੀ ਖੁਸ਼ੀ ਹੁੰਦੀ ਹੈ ਅਤੇ ਅਪ ਇਸ ਤਰ੍ਹਾਂ ਮੈਂ ਆਪਣਾ ਸਮਾਂ ਵੀ ਜਿਹੜਾ ਮੇਰਾ ਵਿਹਲਾ ਸਮਾਂ ਹੁੰਦਾ ਉਹਨੂੰ ਵੀ ਵਰਤ ਲੈਂਦੀ ਹਾਂ ਅਤੇ ਉਹਨੂੰ ਬੇ ਖਰਾਬ ਨਹੀਂ ਕਰਦੀ ਆਪਣੇ ਵਿਹਲੇ ਸਮੇਂ ਨੂੰ ਕਿਸੇ ਕੰਮ 'ਚ ਲਾ ਲੈਂਦੀ ਹਾਂ ਜਾਂ ਕੋਈ ਕਈ ਵਾਰੀ ਮੈਂ ਘਰ ਦੇ ਕੰਮ ਹੁੰਦੇ ਜਾਂ ਉਹ ਕਰ ਲੈਂਦੀ ਹਾਂ ਅਲੱਗ ਅਲੱਗ ਤਰ੍ਹਾਂ ਦੀ ਮੈਨੂੰ ਕੋਈ ਕੋਈ ਵੀ ਕੰਮ ਹੋਵੇ ਜਿਹ ਨਾਲ ਮੈਨੂੰ ਖੁਸ਼ੀ ਮਿਲਦੀ ਹੈ ਮੈਂ ਉਹ ਅਲੱਗ ਅਲੱਗ ਤਰ੍ਹਾਂ ਦੇ ਕੰਮ ਕਰਕੇ ਆਪਣਾ ਸਮਾਂ ਬਤੀਤ ਕਰਦੀ